ਸਤਿ ਸ਼੍ਰੀ ਅਕਾਲ ਵੀਰ ਜੀ ਤੁਸੀਂ ਓਲਾ ਕੰਪਨੀ ਤੋਂ ਬੋਲ ਰਹੇ ਹੈ ਮੈਂ ਗਗਨਦੀਪ ਕੌਰ ਬੋਲ ਰਹੀ ਹਾਂ ਬਠਿੰਡਾ ਤੋਂ ਮੈਂ ਨਾ ਕੱਲ੍ਹ ਇੱਕ ਕੈਬ ਬੁੱਕ ਕੀਤੀ ਸੀ ਤੁਹਾਡੇ ਤੋਂ ਹੀ ਅਤੇ ਮੈਨੂੰ ਉਹ ਸੁਬਾਹ ਨੌਂ ਵਜੇ ਦੀ ਬੁੱਕ ਕੀਤੀ ਸੀਗੀ ਐਕਚੁਲੀ ਮੈਂ ਨਾ ਇੱਥੇ ਜਾ ਇੰਟਰਵਿਊ 'ਤੇ ਜਾਣਾ ਸੀਗਾ ਬਹੁਤ ਜ ਅਰਜੈਂਟੀ ਪਹੁੰਚਣਾ ਸੀ ਹੁਣ ਮੈਂ ਆਪਣੀ ਸੇਮ ਉਸ ਡੈਸਟੀਨੇਸ਼ਨ 'ਤੇ ਖੜ੍ਹੀ ਹਾਂ ਜਿਸ ਦੀ ਮੈਂ ਤੁਹਾਨੂੰ ਜ਼ਿਕਰ ਕੀਤਾ ਸੀਗਾ ਤਾਂ ਮੈਂ ਇੱਥੇ ਕਦੋਂ ਦੀ ਵੇਟ ਕਰ ਰਹੀ ਹਾਂ ਹੁਣ ਤਕਰੀਬਨ ਸਾਢੇ ਨੌਂ ਹੋ ਗਏ ਨੇ ਇੱਥੇ ਕੋਈ ਕੈਬ ਨਹੀਂ ਪਹੁੰਚੀ ਤਾਂ ਜਾਂ ਤਾਂ ਮੈਨੂੰ ਕੋਈ ਕੈਬ ਦਾ ਹੱਲ ਕਰ ਦਿਓ ਨਹੀਂ ਤਾਂ ਫਿਰ ਮੇਰੇ ਪੈਸੇ ਵਾਪਸ ਕਰ ਦਿਓ ਤਾਂ ਜੋ ਮੈਂ ਕੋਈ ਹੋਰ ਆਪਣਾ ਨ ਵਹੀਕਲ ਕਰਕੇ ਚਲੀ ਜਾਵਾਂ ਕਿਉਂਕਿ ਮੈਂ ਬਹੁਤ ਸਫ਼ਰ ਕਰ ਰਹੀ ਹਾਂ ਇਸ ਚੀਜ਼ ਤੋਂ ਮੈਂ ਇੰਟਰਵਿਊ 'ਤੇ ਪਹੁੰਚਣ 'ਤੇ ਲੇਟ ਹੋ ਜੂੰਗੀ ਉੱਥੇ ਮੈਨੂੰ ਉਹ ਨਿਕਾਲ ਦੇਣਗੇ ਤਾਂ ਮੈਨੂੰ ਤਾਂ ਇਹ ਸੁਣਿਆ ਸੀ ਵੀ ਤੁਹਾਡੀ ਕੰਪਨੀ ਬਹੁਤ ਅੱਛੀ ਸਰਵਿਸ ਦਿੰਦੀ ਹੈ ਪਰ ਮੈਂ ਇੱਥੇ ਕਦੋਂ ਦੀ ਅੱਧਾ ਘੰਟਾ ਹੋ ਗਿਆ ਵੇਟ ਕਰ ਰਹੀ ਹਾਂ ਅਜੇ ਤੱਕ ਤੁਹਾਡਾ ਨਾ ਤੁਹਾਡੇ ਡਰੈਵਰ ਦੀ ਲੋਕੇਸ਼ਨ ਟਰੈਕ ਹੋ ਰਹੀ ਹੈ ਕੁਛ ਵੀ ਨਹੀਂ ਹੋ ਰਿਹਾ ਤਾਂ ਮੈਂ ਇੱਥੇ ਵੇਟ ਕਰ ਰਹੀ ਹਾਂ ਕਦੋਂ ਦੀ ਤਾਂ ਤੁਸੀਂ ਜਾਂ ਤਾਂ ਉਸ ਡਰੈਵਰ ਦੇ ਕੋ ਪ੍ਰ ਪ੍ਰਤੀ ਕੋਈ ਐਕਸ਼ਨ ਲਓ ਨਹੀਂ ਮੇਰੇ ਪੈਸੇ ਵਾਪਸ ਕਰੋ ਤਾਂ ਜੋ ਮੈਂ ਆਪਣੀ ਹੋਰ ਕੈਬ ਕਰਕੇ ਚਲੀ ਜਾਵਾਂ